ਸਾਡੇ ਬੱਚੇ ਇੰ ਇੰਟਰਨੈਟ 'ਤੇ ਹੀ ਬੈਠੇ ਰਹਿੰਦੇ ਹਨ ਮੋਬਾਇਲ ਲੈ ਕੇ ਬੈਠੇ ਰਹਿੰਦੇ ਹਨ ਅਸੀਂ ਇਹਨਾਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਦਾ ਖਹਿੜਾ ਛੱਡੋ ਬਾਹਰ ਚਲੇ ਜਾਓ ਗੇਮਾਂ ਕੰਨੀ ਜਾਓ ਬਾਹਰ ਜਿੰਮ ਲਾਓ ਬੈਠ ਕੇ ਆਪਣੀ ਸਿਹਤ ਬਣਾਓ ਆਪਣਾ ਭਾਰ ਘਟਾਓ ਇਹਨਾਂ ਬੱਚਿਆਂ ਨੂੰ ਅਸੀਂ ਬਹੁਤ ਸਿੱਖਿਆ ਦੇ ਰਹੇ ਹਾਂ ਪਰ ਇਹ ਸਮਝ ਨਹੀਂ ਲੈ ਰਹੇ ਅਤੇ ਇ ਇਸ ਕਰਕੇ ਇਹਨਾਂ ਨੂੰ ਇੰਟਰਨੈਟ ਤੋਂ ਦੂਰ ਰੱਖਣ ਲਈ ਕਹਿ ਰਹੇ ਹਾਂ ਅੱਖਾਂ ਦੀ ਨਿਗਾਹ ਚਲੀ ਜਾਂਦੀ ਹੈ ਇਹਨਾਂ ਤੋਂ ਅਤੇ ਇਹਨਾਂ ਨਾਲ ਇਹਨਾਂ ਦੀ ਬੱਚਿਆਂ ਦੀ ਸਿਹਤ ਵੀ ਖਰਾਬ ਹੁੰਦੀ ਹੈ ਅਤੇ ਇਹਨਾਂ ਨਾਲ ਕਈ ਹੋਰ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਬੱਚੇ ਅਤੇ ਹੈਂ ਬੱਚਿਆਂ ਨੂੰ ਕਈ ਕਿਸੇ ਨੂੰ ਕੋਈ ਕਿੱਦਾਂ ਦੀ ਤਕਲੀਫ ਆ ਜਾਂਦੀ ਹੈ ਕੋਈ ਕਿ ਕੋਈ ਹੈਂਡੀਕੈਪ ਹੋ ਜਾਂਦਾ ਇਹਨਾਂ ਨਾਲ ਕੋਈ ਕਿਵੇਂ ਹੋ ਜਾਂਦਾ ਹੈ ਇਹਨਾਂ ਨਾਲ ਇਹਨਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ ਇਹ ਲਈ ਇਸ ਲਈ ਇਹਨਾਂ ਨਾਲ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ